ਤੈਰਾਕੀ ਇੱਕ ਐਸੀ ਖੇਡ ਹੈ ਜੋ ਕਿ ਸਾਡੇ ਪੂਰੇ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਖ਼ਾਸ ਤੌਰ 'ਤੇ ਸਾਹ ਨਿਯੰਤਰਣ ਦੇ ਲਈ ਤੈਰਾਕੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ ਤੈਰਾਕੀ ਦੇ ਨਾਲ ਜਿੱਥੇ ਸਾਡੀ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ ਉਸਦੇ ਨਾਲ ਹੀ ਸਾਡੇ ਫੇਫੜੇ ਇਸ ਦੇ ਨਾਲ ਬਹੁਤ ਤੰਦਰੁਸਤ ਰਹਿੰਦੇ ਹਨ